ਤਕਨੋਲਜੀ ਦੇ ਬੁਨਿਆਦੀ ਰੂਪ ਕਈ ਹਨ ਜਿਵੇਂ ਕਿ ਫੋਨ ਹੈ ਮੋਬਾਈਲ ਫੋਨ ਹੈ ਇੰਟਰਨੈਟ ਹੈ ਇਹਦੇ ਥ ਥਰੂ ਕਈ ਕੰਮ ਆਸਾਨ ਹੋ ਗਏ ਹਨ ਜ ਜਿਵੇਂ ਕਿ ਬੈਂਕਾਂ ਲਈ ਕੰਮ ਨੇ ਉਹ ਕ ਕਿਸੇ ਵੀ ਥਾਂ 'ਤੇ ਪੈਸੇ ਭ ਭੇਜੇ ਜਾ ਸਕਦੇ ਸਨ ਮੰਗਵਾਏ ਜਾ ਸਕਦੇ ਹਨ ਫੋਨ 'ਤੇ ਕਿਧਰੇ ਵੀ ਕਿਸੇ ਵੀ ਦੁਨੀਆਂ ਦੇ ਨੁੱਕਰ ਵਿੱਚ ਗੱਲ ਕੀਤੀ ਜਾ ਸਕਦੀ ਹੈ